ਹਾਂਜੀ ਮੇਰੀ ਪਸੰਦੀ ਦੀ ਗੇਮ ਕ੍ਰਿਕਟ ਵਾ ਅਤੇ ਮੈਨੂੰ ਇਨ੍ਹਾਂ ਕ੍ਰਿਕਟ ਵਿੱਚੋਂ ਸਾਰੇ ਖਿਡਾਰੀ ਬੜੇ ਪਸੰਦ ਵਾ ਸਾਰੇ ਵਧੀਆ ਖੇਡਦੇ ਆ ਪਰ ਮੈਨੂੰ ਸਚਿਨ ਤੇਂਦੂਲਕਰ ਬਹੁਤ ਵਧੀਆ ਲੱਗਦੇ ਆ ਅਤੇ ਉਹਨਾਂ ਦਾ ਮੈਨੂੰ ਪੀ ਇਸ ਕਰਕੇ ਵਧੀਆ ਲੱਗਦੇ ਕਿ ਉਹ ਆਪਣੇ ਇੱਕ ਠੰਡੇ ਸੁਭਾਅ ਨਾਲ ਰਹਿ ਕੇ ਖੇਡਦੇ ਆ ਉਹਨਾਂ ਆਪਣੀ ਇੰਨੀ ਵੱਡੀ ਜ਼ਿੰਦਗੀ ਜੀ ਹੈ ਇਸੀ ਵੀ ਲਾਈਫ ਵਿਚ ਅਤੇ ਉਹਨਾਂ ਨੇ ਇੱਕ ਕਦੇ ਕਾਹਲੀ ਨਹੀਂ ਕਰਦੇ ਉਹ ਚੀਜ਼ ਨੂੰ ਲੈ ਕੇ ਕਿ ਉਹ ਅਸੀਂ ਕਾਹਲੀ ਕਾਹਲੀ ਖੇਡ ਕੇ ਅਤੇ ਆਊਟ ਹੋ ਕੇ ਅਤੇ ਪਾਸੇ ਹੋ ਜਾਈਏ ਉਹਨਾਂ ਦੇ ਮੈਨੂੰ ਇਹ ਗੁਣ ਬਹੁਤ ਪਸੰਦ ਵਾ ਉਹਨਾਂ ਬਾਰੇ ਮੈਨੂੰ ਇਹੋ ਵਧੀਆ ਲੱਗਦਾ ਵਾ ਕਿ ਜੇ ਉਹ ਮਤਲਬ ਵੀ ਖੇਡਦੇ ਹਨ ਹੌਂਸਲੇ ਨਾਲ ਖੇਡਦੇ ਆ ਅਤੇ ਸਾਰੇ ਬੱਚਿਆਂ ਨੂੰ ਇਹੋ ਚੀਜ਼ ਸਮਝ ਆਉਂਦੀ ਆ ਵੇਖ ਕੇ ਕਿ ਉਹ ਵਧੀਆ ਖੇਡਣ ਡਏ ਆ ਇੰਨਾਂ ਟਾਈਮ ਉਹਨਾਂ ਨੇ ਖੇਡਿਆ ਵਾ ਕ੍ਰਿਕਟ ਨੂੰ ਲੈਕੇ ਕਦੇ ਉਹਨਾਂ ਕਾਹਲੀ ਨਹੀਂ ਕੀਤੀ ਬਹੁਤ ਵਧੀਆ ਖੇਡਦੇ ਆ ਅਤੇ ਜੇ ਮੈਂ ਉਹਨਾਂ ਨੂੰ ਮਿਲਦੀ ਹਾਂ ਤਾਂ ਮੈਂ ਉਹਨਾਂ ਨੂੰ ਇਹੋ ਮਿਲਕੇ ਪੁੱਛਾਂਗੀ ਕਿ ਸਾਨੂੰ ਵੀ ਤੁਸੀਂ ਇਹ ਸਿੱਖਿਆ ਦਿਓ ਕਿੱਦਾਂ ਤੁਸੀਂ ਕਰਦੇ ਜੇ ਕਿੱਦਾਂ ਖੇਡਦੇ ਜੇ ਅਸੀਂ ਆਪਣੇ ਬੱਚਿਆਂ ਨੂੰ ਮਿਲਾਉਣਾ ਚਾਹਵਾਂਗੇ ਅਗਾਂਹ ਉਹਨਾਂ ਨਾਲ ਅਤੇ ਉਹਨਾਂ ਕੋਲੋਂ ਇਹ ਗੁਣ ਲੈਣਾ ਚਾਹਵਾਂਗੇ ਵੀ ਇੰਨੀ ਸਹਿਨਸ਼ੀਲਤਾ ਇੰਨਾਂ ਵਧੀਆ ਤੁਸੀਂ ਕਿੱਥੋਂ ਖੇਡਣਾ ਸਿੱਖਿਆ ਅਤੇ ਸਾਨੂੰ ਵੀ ਇਹ ਚੀਜ਼ ਬਾਰੇ ਸਮਝਾਓ ਅਤੇ ਕਿਵੇਂ ਖੇਡ ਸਕੀਏ ਅਸੀਂ ਇਹ ਚੀਜ਼